ਜੀ ਸਾਡੇ ਖੇਤਰ ਵਿੱਚ ਬਹੁਤ ਸਾਰੇ ਇਤਿਹਾਸਿਕ ਨਿਸ਼ਾਨੀਆਂ ਵਾਲੇ ਸਥਾਨ ਹਨ ਇੱਕ ਰਾਜਾ ਰਣਜੀਤ ਸਿੰਘ ਦਾ ਪਾਰਕ ਹੈ ਅਤੇ ਸਿੰਧੂ ਘਾਟੀ ਅਤੇ ਖਟਕੜ ਪਿੰਡ ਵਿੱਚ ਭਗਤ ਸਿੰਘ ਦਾ ਮਿਊਜ਼ੀਅਮ ਅਤੇ ਗੁਰਦੁਆਰਾ ਅਤੇ ਮਸਜਿਦ ਅਤੇ ਪੀਰ ਬਾਬਾ ਅਸੀਂ ਹਰ ਜਗ੍ਹਾ ਮੈਂ ਹਰ ਜਗ੍ਹਾ ਘੁੰਮਣ ਗਈ ਹਾਂ ਮਸਜਿਦ ਵੀ ਦੇਖਣ ਵਿੱਚ ਬਹੁਤ ਸੁੰਦਰ ਅਤੇ ਉਹਦਾ ਗੁੰਬਦ ਵੀ ਬਹੁਤ ਸੁੰਦਰ ਸੀ ਉੱਥੇ ਜਾ ਕੇ ਦਿਲ ਨੂੰ ਸ਼ਾਤੀ ਮਿਲਦੀ ਹੈ ਅਤੇ ਮੈਂ ਪੀਰ ਬਾਬਾ ਵੀ ਦੀ 'ਤੇ ਵੀ ਗਈ ਆ ਉਹ ਪਹਾੜੀਆਂ ਦੇ ਉੱਚੇ ਸਥਾਨ 'ਤੇ ਹੈ ਜਿੱਥੇ ਉੱਤੇ ਜਾਣ ਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਮਿਊਜ਼ੀਅਮ ਵਿੱਚ ਬਹੁਤ ਸਾਰੇ ਸਮਾਨ ਹੈ ਜੋ ਉਹਨਾਂ ਨੂੰ ਯਾਦ ਦਿਲਾਉਂਦੀ ਹੈ ਉਨ੍ਹਾਂ ਦੀ ਭਗਤ ਸਿੰਘ ਬਾਰੇ ਉਨ੍ਹਾਂ ਦੇ ਸਾਨੂੰ ਯਾਦ ਦਿਲਾਉਂਦੀ ਹੈ ਕਿ ਉਹ ਉਹ ਕਿਵੇਂ ਦੇ ਸਨ ਅਤੇ ਕੀ ਕਰਦੇ ਸਨ ਰਾਜਾ ਰਣਜੀਤ ਸਿੰਘ ਦੇ ਪਾਰਕ ਵਿੱਚ ਬਹੁਤ ਸਾਰੇ ਬਹੁਤ ਸਾਰੇ ਦੇਖਣ ਨੂੰ ਬਹੁਤ ਵਧੀਆ ਵਧੀਆ ਚੀਜ਼ ਹਨ ਝੂਲੇ ਲੱਗੇ ਨੇ ਅਤੇ ਉੱਥੇ ਉੱਥੇ ਖੇਡਣ ਨੂੰ ਮੈਦਾਨ ਵੀ ਹੈ ਅਤੇ ਉਨ੍ਹਾਂ ਵਿੱਚ ਬਹੁਤ ਸਾਰੀਆਂ ਮੂਰਤੀਆਂ ਬਣੀਆ ਨੇ ਜੋ ਦੇੇਖਣ ਵਿੱਚ ਬਹੁਤ ਸੁੰਦਰ ਲੱਗਦੇ ਅਤੇ ਪੁਰਾਣੇ ਯਾਦ ਨੂੰ ਦਿਖਾ ਪੁਰਾਣੀ ਯਾਦਾਂ ਨੂੰ ਦਰਸਾਉਂਦੇ ਨੇ ਅਤੇ ਮਿਊਜ਼ੀਅਮ ਵਿੱਚ ਬਹੁਤ ਪੁਰਾਣੇ ਯਾਦਾਂ ਨੂੰ ਰੱਖੇ ਹੋਏ ਹੈ ਜੋ ਸਾਨੂੰ ਦੇਖ ਕੇ ਉਹਨਾਂ ਬਾਰੇ ਯਾਦ ਦਿਲਾਉਂਦੀਆਂ ਨੇ